ਹੈਲੋ ਹੈਲੋ ਇੰਟੀਰੀਅਰ ਡਿਜ਼ਾਇਨਰ ਬੋਲ ਰਹੇ ਹੋ ਜੀ ਹਾਂਜੀ ਆਪਾਂ ਜੀ ਆਪਣਾ ਘਰ ਹੈਗਾ ਇੱਧਰ ਰਾਧੇ ਸੁਆਮੀ ਕਲੋਨੀ ਵਾਲੀ ਸਾਈਡ ਫਾਜ਼ਿਲਕਾ ਅਤੇ ਆਪਣਾ ਦਸ ਮਰਲਿਆਂ 'ਚ ਘਰ ਹੈ ਅਤੇ ਆਪਾਂ ਮਤਲਬ ਵਾਹਵਾ ਟਾਈਮ ਹੋ ਗਿਆ ਘਰ ਨੂੰ ਬਣਾਏ ਨੂੰ ਅ ਦਸ ਮਰਲੇ ਹੋ ਗਏ ਚੁਤਾਲੀ ਫੁੱਟ ਅੱਗੋਂ ਅਤੇ ਸੱਠ ਫੁੱਟ ਲੰਬਾ ਹੈ ਜੀ ਹਾਂ ਚੁਤਾਲੀ ਫੁੱਟ ਬਰੈਥ ਹੋ ਗਈ ਅਤੇ ਲੈਂਥ ਹੋ ਗਈ ਉਹਦੀ ਸੱਠ ਫੁੱਟ ਹਾਂ ਇੰਨਾ ਕੁ ਹੀ ਹੈ ਜੀ ਅਤੇ ਆਹ ਅੱਛਾ ਜੀ ਅਤੇ ਆਪਾਂ ਕਾਉਂਸਲਿੰਗ ਦੇ ਨਾਲ ਨਾਲ ਛੱਤ ਤਾਂ ਇਨਚੀ ਹੈ ਪਰ ਆਪਣੇ ਕੋਲ ਐਵੇਂ ਹੈ ਨਾ ਵੀ ਆਪਣਾ ਤਿੰਨ ਮੰਜ਼ਲੀ ਹੈ ਘਰ ਅਤੇ ਅਤੇ ਕਮਰੇ ਵਾਹ ਵਾਹ ਹੀ ਹੈ ਕਮਰੇ ਮਤਲਬ

ਨਹੀਂ ਤ ਆਪਣਾ ਨਹੀਂ ਆਪਾਂ ਇਹ ਇੰਟੀਰੀਅਰ ਡਿਜ਼ਾਇਨਰ ਕਰਨਾ ਆਪਾਂ ਪੱਥਰ ਵਗੈਰਾ ਵੀ ਲਵਾਉਣਾ ਮਤਲਬ ਸਾਰਾ ਕੁਝ ਹੀ ਕਰਵਾਉਣਾ ਘਰ ਦੇ ਵਿੱਚ ਤਿੰਨੋ ਮੰਜ਼ਲ 'ਤੇ ਅਪ ਆਪਣੇ ਕੋਲ ਸਾਰਾ ਹੀ ਮਤਲਬ ਅਵੇਲੇਬਲ ਹੈ ਆਪਣੇ ਕੋਲ ਮੈਂ ਤੁਹਾਨੂੰ ਦੱਸ ਦਿਆਂ ਆਪਣੇ ਕੋਲ ਟੋਟਲ ਨਹੀਂ ਆਪਣੇ ਕੋਲ ਵੈਸੇ ਦੱਸ ਰੂਮ ਹੈਗੇ ਹੈ ਟੋਟਲ ਅਤੇ ਜਿਹਨਾਂ ਵਿੱਚੋਂ ਮਤਲਬ ਰੂਮ ਵੱਡੇ ਹੀ ਆ ਆਪਾਂ ਐਵੇਂ ਨਹੀਂ ਕਹਿ ਸਕਦੇ ਅਤੇ ਉਹ ਤੁਸੀਂ ਆਪਣੇ ਹਿਸਾਬ ਨਾਲ ਵੇਖ ਲਿਓ ਜਿਵੇਂ ਵੀ ਤੁਹਾਨੂੰ ਸੈੱਟ ਲੱਗਦਾ ਉਹ ਤੁਸੀਂ ਡਿਜ਼ਾਇਨ ਐਵੇਂ ਕਰੋ ਤੁਹਾਡੇ ਕੋਲ ਡਿਜ਼ਾਇਨ ਤਾਂ ਅਵੇਲੇਬਲ ਹੋਣੇ ਹੀ ਹੈ ਆ ਕੋਈ ਤੁਹਾਨੂੰ ਜਿੰਨੇ ਚਲੋ ਲਾਈਟ ਨਹੀਂ ਸਰ ਕੋਈ ਨਹੀਂ ਤਾਂ ਹੀ ਤਾਂ ਤੁਹਾਨੂੰ ਕਾਲ ਕੀਤਾ ਤੁਹਾਡਾ ਨਾਮ ਵਾਹ ਵਧੀਆ ਚਲੋ ਕੋਈ ਨਹੀਂ ਸਰ ਤੁਸੀਂ ਐਂ ਕਰੋ ਜਿੰਨੇ ਵੀ ਤੁਹਾਡੇ ਕੋਲ ਰੂ ਜਿੰਨੇ ਵੀ ਤੁਹਾਡੇ ਕੋਲ ਕਰ ਦਿਓ ਬਾਹਰ ਦੇ ਰੂਮ ਦੇ ਅੰਦਰ ਦੇ ਸਾਰੀ ਪਿਕ ਮੈਨੂੰ ਡਿਜ਼ਾਇਨਾਂ ਦੀ ਸਾਰੀ ਸੈਂਡ ਕਰ ਦਿਓ ਵਟਸਐਪ 'ਤੇ ਮੈਂ ਚੂਜ਼ ਕਰ ਲੈਂਦਾ ਅਤੇ ਉਸ ਤੋਂ ਬਾਅਦ ਤੁਹਾਨੂੰ ਫੋਨ ਕਰਨਾ

ਸ ਸਭ ਸਭ ਕੁਝ ਪਾਇਆ ਹੈ ਜੀ ਬਸ ਆਪਾਂ ਡਿਜ਼ਾਇਨ ਕਰਾਉਣਾ ਹੈ ਥੋੜ੍ਹਾ ਬਹੁਤ ਠੀਕ ਠੀਕ ਹੈ ਠੀਕ ਹੈ ਠੀਕ ਹੈ ਜੀ ਓਕੇ ਜੀ